ਖੇਤੀਬਾੜੀ ਵਿੱਚ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਹਾਂ ਕਿਉਂਕਿ ਜਦੋਂ ਵੀ ਸੀਜ਼ਨ ਹੁੰਦਾ ਹੈ ਕਣਕ ਦਾ ਹੋਵੇ ਜਾਂ ਝੋਨੇ ਦਾ ਹੋਵੇ ਤਾਂ ਸਾਨੂੰ ਉਹਨੂੰ ਮੌਕੇ 'ਤੇ ਸੰਭਾਲਣਾ ਪੈਂਦਾ ਹੈ ਅਤੇ ਸਾਨੂੰ ਕਈ ਵਾਰ ਦੂਜੇ ਭੈਣ ਭਰਾਵਾਂ ਦੇ ਕੋਲੋਂ ਟਰੈਕਟਰ ਟਰਾਲੀ ਵੀ ਮੰਗਣਾ ਪੈਂਦਾ ਹੈ ਅਤੇ ਤਾਂ ਹੀ ਅਸੀਂ ਉਹਨੂੰ ਖੇਤੀਬਾੜੀ ਨੂੰ ਸਾਂਭ ਸਕਦੇ ਹਾਂ ਕਿਉਂਕਿ ਕਈ ਵਾਰ ਮੀਂਹ ਦੇ ਸ਼ੀਜ਼ਨ ਦੇ ਵਿੱਚ ਵੀ ਅਸੀਂ ਜਿਹੜੀ ਫਸਲ ਕੱਟੀ ਹੁੰਦੀ ਹੈ ਕਣਕ ਜਾਂ ਝੋਨਾ ਉਹਨੂੰ ਅੰਦਰ ਵੀ ਕਰਨਾ ਪੈਂਦਾ ਅਤੇ ਅਸੀਂ ਇੱਕ ਦੂਜੇ ਦੇ ਬਰਾਂਡੇ ਦੇ ਵਿੱਚ ਜਾ ਕੇ ਅਤੇ ਅਸੀਂ ਉਹ ਟਰਾਲੀਆਂ ਲਗਾ ਲੈਂਦੇ ਹਾਂ ਅਤੇ ਕਿਸਾਨਾਂ ਦਾ ਵੀ ਇੱਕ ਦੂਜੇ ਦੇ ਨਾਲ ਕਾਫੀ ਸਮਰਥਨ ਰਹਿੰਦਾ ਹੈ ਕਿਸਾਨਾਂ ਨੂੰ ਜਦੋਂ ਵੀ ਕਿਤੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਾਰੇ ਕਿਸਾਨ ਇਕੱਠੇ ਹੋ ਕੇ ਉਸ ਮੁਸ਼ਕਲ ਦਾ ਹੱਲ ਲੱਭਦੇ ਆ ਅਤੇ ਅਸੀਂ ਜੇਕਰ ਕੋਈ ਕਿਸਾਨ ਰੱਬ ਨਾ ਕਰੇ ਕਿ ਉਹ ਬਿਮਾਰ ਪੈ ਜਾਵੇ ਜਾਂ ਉਹ ਢਿੱਲਾ ਮੱਠਾ ਹੁੰਦਾ ਜਾਂ ਉਹਦੀ ਡੈੱਥ ਹੋ ਜਾਂਦੀ ਆ ਅਤੇ ਅਸੀਂ ਸਾਰੇ ਰਲ ਕੇ ਉਹਦਾ ਬਾਹਰ ਖੇਤੀਬਾੜੀ ਅਸੀਂ ਦੇਖਦੇ ਹਾਂ ਅਤੇ ਉਹਦੇ ਵਿੱਚ ਅਸੀਂ ਉਹਦੀ ਹੈਲਪ ਕਰਦੇ ਹਾਂ ਕਿਉਂਕਿ ਇਹ ਜਿਹੜਾ ਖੇਤੀਬਾੜੀ ਦੇ ਵਿੱਚ ਜਿਹੜੀ ਸਾਡੀ ਫਸਲ ਹੈ ਉਹਨੂੰ ਸੰਭਾਲਣਾ ਜ਼ਰੂਰੀ ਹੈ ਅਤੇ ਜਦੋਂ ਵੀ ਕਿਸ ਸਰਕਾਰ ਦੇ ਨਾਲ ਵੀ ਕਿਤੇ ਕੋਈ ਮੰਗ ਅਸੀਂ ਮੰਗਦੇ ਹਾਂ ਨਾ ਮੰਨੀ ਜਾਵੇ ਅਸੀਂ ਇਕੱਠੇ ਹੋ ਕੇ ਅਤੇ ਜਾ ਕੇ ਧਰਨਾ ਵੀ ਲਗਾਉਂਦੇ ਹਾਂ ਇਸ ਕਰਕੇ ਸਾਨੂੰ ਸਾਰਿਆਂ ਦੀ ਇੱਕ ਦੂਜੇ ਦੀ ਲੋੜ ਪੈਂਦੀ ਹੈ